ਮੈਂ ਰਾਜ ਕੁਮਾਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਪਛੜੇ ਹੋਏ ਖੇਤਰਾਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਅੱਜ ਦੇ ਪਿੰਡਾਂ ਵਿੱਚ ਕਾਫੀ ਹੀ ਘਾਟ ਹੈ ਜਿਵੇਂ ਕਿ ਆਵਾਜਾਈ ਲਾਈਟ ਸਮੇਂ ਸਿਰ ਨਹੀਂ ਆਉਣਾ ਸਿਹਤ ਸੁਰੱਖਿਆ ਦੀ ਘਾਟ ਅਤੇ ਸਕੂਲਾਂ ਦੀ ਘਾਟ ਜਿਵੇਂ ਕਿ ਕਾਫੀ ਦੂਰ ਦੂਰ ਤੱਕ ਪੜ੍ਹਨ ਜਾਣਾ ਪੈਂਦਾ ਹੈ ਅਤੇ ਆਵਾਜਾਈ ਦਾ ਸਾਧਨ ਨਹੀਂ ਹੈ ਅਤੇ ਲਾਈਟ ਨਹੀਂ ਆਉਂਦੀ ਟਾਈਮ ਸਿਰ ਜਿਵੇਂ ਕਿ ਕਈ ਪਿੰਡਾਂ ਵਿੱਚ ਹਾਲੇ ਤਾਂ ਸੁਵਿਧਾ ਸੈਂਟਰ ਦੀ ਵੀ ਘਾਟ ਹੈ ਟੀ ਵੀ ਲੱਗੇ ਜਿਵੇਂ ਕਿ ਨੈਟਵਰਕ ਨਹੀਂ ਆਉਂਦੇ ਕਈ ਜਗ੍ਹਾ ਤਾਂ ਹਾਲੇ ਪਿੰਡਾਂ ਵਿੱਚ ਮੋਬਾਇਲ ਵੀ ਨਹੀਂ ਚੱਲਦਾ ਹੈ ਨੈਟਵਰਕ ਨਹੀਂ ਆਉਂਦਾ ਹੈ ਅਤੇ ਆਵਾਜਾਈ ਵੀ ਸਮੇਂ ਸਿਰ ਨਹੀਂ ਪੁੱਜਦੀ ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਉਹਨਾਂ ਨੂੰ ਕਾਫੀ ਦੂਰ ਦੂਰ ਤੱਕ ਆਵਾਜਾਈ ਦਾ ਸਮਾਨ ਲੈਣ ਜਿਵੇਂ ਰਾਸ਼ਨ ਵਗੈਰਾ ਵੀ ਕਾਫੀ ਦੂਰ ਜਾਣਾ ਪੈਂਦਾ ਹੈ